ਖੇਡਾਂ ਦਾ ਸਾਡੇ ਜੀਵਨ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੈ ਖੇਡਾਂ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਵੇਂ ਕਿ ਪੜ੍ਹਨਾ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਉਸ ਤਰੀਕੇ ਖੇਡਣਾ ਵੀ ਆਪਣੇ ਵਾਸਤੇ ਉੱਨਾਂ ਹੀ ਜ਼ਰੂਰੀ ਹੈ ਖੇਡਾਂ ਨਾਲ ਸਾਡਾ ਸਰੀਰ ਚੁਸਤ ਅਤੇ ਤੰਦਰੁਸਤ ਰਹਿੰਦਾ ਹੈ ਖੇਡਾਂ ਕਾਰਨ ਹੀ ਅਸੀਂ ਆਪਣੇ 'ਚ ਸਰੀਰ ਨੂੰ ਤੰਦਰੁਸਤ ਅਤੇ ਫੁਰਤੀਲਾ ਮਹਿਸੂਸ ਕਰਦੇ ਹਾਂ ਜੇਕਰ ਅਸੀਂ ਖੇਡਦੇ ਹਾਂ ਤਾਂ ਹੀ ਅਸੀਂ ਆਪਦੀ ਪੜ੍ਹਾਈ 'ਤੇ ਚੰਗੀ ਤਰ੍ਹਾਂ ਲਗਨ ਨਾਲ ਪੜ੍ਹ ਸਕਦੇ ਹਾਂ ਜੇਕਰ ਅਸੀਂ ਪੜ੍ਹਾਈ ਤੇ ਚੰਗਾ ਪੜ੍ਹਨ ਪੜ੍ਹਾਈ 'ਤੇ ਚੰਗਾ ਕਰਨਾ ਚਾਹੁੰਦੇ ਹਾਂ ਅਤੇ ਸਾਨੂੰ ਖੇਡਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਅਸੀਂ ਖੇਡਦੇ ਨਹੀਂ ਤਾਂ ਸਾਡਾ ਸਰੀਰ ਚੁਸਤ ਨਹੀਂ ਰਹਿੰਦਾ ਜੇਕਰ ਸਾਡਾ ਸਰੀਰ ਚੁਸਤ ਨਹੀਂ ਹੈ ਤੰਦਰੁਸਤ ਨਹੀਂ ਹੈ ਤਾਂ ਸਾਡਾ ਦਿਮਾਗ ਵੀ ਫੁਰਤੀਲਾ ਅਤੇ ਤੰਦਰੁਸਤ ਨਹੀਂ ਰਹੇਗਾ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਰੀਰ ਤੰਦਰੁਸਤ ਰਹੇ ਅਤੇ ਅਸੀਂ ਪੜ੍ਹਾਈ ਵਿੱਚ ਵੀ ਵਧੀਆ ਤੋਂ ਵਧੀਆ ਅੰਕ ਹਾਸਿਲ ਕਰੀਏ ਤਾਂ ਸਾਡੇ ਵਾਸਤੇ ਖੇਡਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅੱਜ ਕੱਲ੍ਹ ਪੜ੍ਹਾਈ ਦੇ ਨਹੀਂ ਬਲਕਿ ਖੇਡਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਨਾਮ ਕਮਾ ਚੁੱਕੇ ਹਾਂ ਚੁੱਕੇ ਹੈ ਸਾਡੇ ਕਈ ਭਾਰਤ ਦੇ ਖਿਡਾਰੀ ਜਿਵੇਂ ਕਿ ਵਿਰਾਟ ਕੋਹਲੀ ਉਹ ਕ੍ਰਿਕਟ ਵਿੱਚ ਇੱਕ ਬਹੁਤ ਵੱਡਾ ਨਾਮ ਸਾਬਿਤ ਹੋਏ ਹੈ ਅਤੇ ਹੋਰ ਵੀ ਕਈ ਇਹੋ ਜਿਹੀਆਂ ਉਦਾਹਰਨਾਂ ਹਨ ਜਿੱਥੇ ਖੇਡਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਬਹੁਤ ਜ਼ਿਆਦਾ ਪੈਸਾ ਕਮਾਇਆ ਅਤੇ ਬਹੁਤ ਜ਼ਿਆਦਾ ਇੱਜ਼ਤ ਵੀ ਕਮਾਈ ਹੈ ਸਿ ਸਿਰਫ ਪੜ੍ਹਾਈ ਨਾਲ ਹੀ ਅਸੀਂ ਇੱਜ਼ਤ ਨਹੀਂ ਕਮਾ ਸਕਦੇ ਖੇਡਾਂ ਨਾਲ ਵੀ ਅਸੀਂ ਆਪਣੀ ਇੱਜ਼ਤ ਬਹੁਤ ਜ਼ਿਆਦਾ ਵਧਾ ਸਕਦੇ ਹਾਂ ਅਤੇ ਬਹੁਤ ਜ਼ਿਆਦਾ ਪੈਸਾ ਵੀ ਕਮਾ ਸਕਦੇ ਹਾਂ ਖੇਡਾਂ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਸਾਨੂੰ ਖੇਡਣਾ ਚਾਹੀਦਾ ਅਤੇ ਪੜ੍ਹਾਈ 'ਤੇ ਵੀ ਪੂਰਾ ਫੋਕ ਪੂਰਾ ਕਰਨਾ ਚਾਹੀਦਾ ਹੈ ਅਤੇ ਖੇਡਾਂ ਨਾਲ ਵੀ ਅਸੀਂ ਪੜ੍ਹਾਈ ਤਾਂ ਪੂਰਾ ਲਗਨ ਨਾਲ ਕਰ ਸਕਦੇ ਹਾਂ ਅਤੇ ਦ ਦੋਨੋਂ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਵੱਧ ਤੋਂ ਵੱਧ ਖੇਡਣਾ ਚਾਹੀਦਾ ਅਤੇ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ